ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਪੇਂਟਿੰਗ ਜਾਂ ਹੱਥ ਨਾਲ ਬਣਾ ਕੇ ਕਾਰਡ ਤੋਹਫ਼ਾ ਦਿੱਤਾ ਹੈ ਅਤੇ ਇਹ ਤੋਹਫ਼ਾ ਮੈਂ ਆਪਣੀ ਸਹੇਲੀ ਨੂੰ ਉਸਦੇ ਜਨਮ ਦਿਨ 'ਤੇ ਦਿੱਤਾ ਸੀ ਮੇਰੀ ਸਹੇਲੀ ਜੋ ਕੀ ਮੇਰੀ ਬਚਪਨ ਦੀ ਸਹੇਲੀ ਸੀ ਉਸ ਦੇ ਜਨਮਦਿਨ 'ਤੇ ਮੈਂ ਬਹੁਤ ਸੋਚਿਆ ਕਿ ਮੈਂ ਉਸਨੂੰ ਕੀ ਤੋਹਫ਼ਾ ਦੇਵਾਂ ਪਰ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਉਸ ਨੂੰ ਆਪਣੇ ਹੱਥ ਦੇ ਨਾਲ ਬਣਾ ਕੇ ਕਾਰਡ ਦਾ ਤੋਹਫ਼ਾ ਦੇ ਸਕਦੀ ਹਾਂ ਅਤੇ ਮੈਨੂੰ ਪੂਰੀ ਉਮੀਦ ਸੀ ਕਿ ਉਹਨੂੰ ਇਹ ਤੋਹਫ਼ਾ ਬਹੁਤ ਪਸੰਦ ਆਵੇਗਾ ਮੈਂ ਸਭ ਤੋਂ ਪਹਿਲਾਂ ਦੁਕਾਨ 'ਤੇ ਜਾ ਕੇ ਇੱਕ ਚਿੱਟੇ ਰੰਗ ਦਾ ਚਾਟ ਖਰੀਦਿਆ ਅਤੇ ਚਾਟ ਦੇ ਵਿੱਚ ਆਪਣੀਆਂ ਦੋਵਾਂ ਦੀਆਂ ਮਨਪਸੰਦ ਨਿੱਕੀਆਂ ਨਿੱਕੀਆਂ ਤਸਵੀਰਾਂ ਕੱਟ ਕੇ ਲਗਾਈਆਂ ਤਸਵੀਰਾਂ ਕੱਟਣ ਤੋਂ ਬਾਅਦ ਮੈਂ ਉਸ ਤਸਵੀਰਾਂ ਨੂੰ ਚਾਟ 'ਤੇ ਚਿਪਕਾਇਆ ਅਤੇ ਚਿਪਕਾਉਣ ਤੋਂ ਬਾਅਦ ਮੈਂ ਉਸ ਤਸਵੀਰ ਦੇ ਥੱਲੇ ਆਪਣੇ ਰਿਸ਼ਤੇ ਬਾਰੇ ਦੋ ਤਿੰਨ ਬਹੁਤ ਹੀ ਜ਼ਿਆਦਾ ਮਨਭਾਵਿਕ ਲਾਈਨਾਂ ਲਿਖੀਆਂ ਉਹ ਲਾਈਨਾਂ ਲਿਖਣ ਤੋਂ ਬਾਅਦ ਮੈਂ ਉਸ ਚਾਟ ਨੂੰ ਬਾਹਰੋਂ ਵੀ ਬਹੁਤ ਚੰਗੀ ਤਰ੍ਹਾਂ ਸਜਾਇਆ ਅਤੇ ਸਜਾਉਣ ਤੋਂ ਬਾਅਦ ਮੈਂ ਉਹਦੇ ਉੱਤੇ ਗਿਫਟ ਦਾ ਤੋਫ ਤੋਹਫ਼ੇ ਦਾ ਕਾਗਜ਼ ਚੜਾਇਆ ਜਿਸ ਦਿਨ ਉਸ ਦਾ ਜਨਮਦਿਨ ਸੀ ਉਸ ਦਿਨ ਮੈਂ ਉਸਨੂੰ ਇਹ ਤੋਹਫ਼ਾ ਦਿੱਤਾ ਅਤੇ ਮੇਰੇ ਤੋਹਫ਼ੇ ਨੂੰ ਦੇਖ ਕੇ ਉਸਦਾ ਮਨ ਭਰ ਆਇਆ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਈ ਅਤੇ ਸਾਰੇ ਤੋਹਫ਼ਿਆਂ ਵਿੱਚੋਂ ਉਸ ਨੂੰ ਮੇਰਾ ਤੋਹਫ਼ਾ ਸਭ ਤੋਂ ਵਧੀਆ ਲੱਗਿਆ ਸੀ ਹੱਥ ਨਾਲ ਬਣਾਈਆਂ ਚੀਜ਼ਾਂ ਦਾ ਜ਼ਿਆਦਾ ਭਾਵਨਾਤਮਕ ਮੁੱਲ ਹੁੰਦਾ ਹੈ ਕਿਉਂਕਿ ਉਸ ਵਿੱਚ ਅਸੀਂ ਕੁਝ ਵੀ ਗਲਤ ਇਸਤੇਮਾਲ ਨਹੀਂ ਕਰਦੇ ਅਤੇ ਉਸ ਵਿੱਚ ਅਸੀਂ ਸਾਰਾ ਕੁਝ ਆਪਣੇ ਦਿਲ ਤੋਂ ਕੱਢ ਕੇ ਫਿਰ ਇਸਤੇਮਾਲ ਕਰਦੇ ਹਾਂ ਦਿਲ ਦੀਆਂ ਚੀਜ਼ਾਂ ਅਕਸਰ ਹੀ ਬਹੁਤ ਵਧੀਆ ਹੁੰਦੀਆਂ ਨੇ ਧੰਨਵਾਦ